ਸਤਿ ਸ਼੍ਰੀ ਅਕਾਲ ਜੀ ਅਮਨ ਟਰੈਵਲ ਤੋਂ ਬੋਲਦੇ ਹੈ ਜੀ ਹਾਂ ਹਾਂ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਹੋਰ ਘਰ ਦਾ ਪਰਿਵਾਰ ਦਾ ਘਰ ਪਰਿਵਾਰ ਦਾ ਕੀ ਹਾਲ ਚਾਲ ਆ

ਉਹ ਇਸ ਤਰ੍ਹਾਂ ਐਤਕੀ ਗਰਮੀਆਂ ਦੀਆਂ ਛੁੱਟੀਆਂ 'ਚ ਪਲਾਨ ਕਰ ਰਹੇ ਸੀਗੇ ਵੀ ਚਲ ਆਪਣਾ ਕਸ਼ਮੀਰ ਵਗੈਰਾ ਘੁੰਮ ਆਈਏ ਅਤੇ ਮੈਨੂੰ ਪਤਾ ਲੱਗਿਆ ਤੁਸੀਂ ਤੁਹਾਨੂੰ ਉੱਥੇ ਕਾਫੀ ਉਸ ਚੀਜ਼ ਉਸ ਜਗ੍ਹਾ ਦਾ ਤੁਹਾਡਾ ਹੋਲਡ ਹੈਗਾ ਉਸ ਜਗ੍ਹਾ 'ਤੇ ਅਤੇ ਮੈਨੂੰ ਸਾਨੂੰ ਸਮਝਾਉ ਵੀ ਉਹਦਾ ਕੀ ਪ੍ਰੋਸੈਸ ਹੈਗਾ ਕਿਹੜੇ ਕਿਹੜੇ ਉੱਥੇ ਜਗ੍ਹਾ ਹੈਗੀਆਂ ਵੇਖਣ ਵਾਲੀਆਂ ਅਤੇ ਕੀ ਤੁਹਾਡਾ ਚਾਰਜਿਜ ਕੀ ਹੋਣਗੇ ਹੈਂ ਅਤੇ ਕਿਰਪਾ ਕਰਕੇ ਉਹ ਸਮਝਾਉ ਸਾਨੂੰ ਜੀ ਫਿਰ ਗੱਲ ਕਰਦੇ ਆਪਾਂ ਅਗਲੀ

ਹਾਂਜੀ

ਹਾਂਜੀ ਹਾਂਜੀ ਹਾਂਜੀ ਅਤੇ ਇਹ ਡੱਲ ਝੀਲ ਕਿਹੜੇ ਪਾਸੇ ਪੈਂਦੀ ਹੈ ਜੀ ਇਹ ਸ਼੍ਰੀਨਗਰ 'ਚ ਠੀਕ ਹੈ ਠੀਕ ਹੈ ਆਹੀ ਆ ਵ ਬ ਟੋਟਲ ਅਸੀਂ ਸਮਝ ਲਉ ਬੇਟਾ ਬੇਟੀ ਆ ਅਤੇ ਵਾ ਵਾਈਫ ਆ ਅਸੀਂ ਟੋਟਲ ਚਾਰ ਜਾਣੇ ਆ ਅਤੇ

ਅੱਛਾ ਅੱਛਾ ਨਹੀਂ ਜਿਹੜੇ ਜਿਹੜਾ ਆਪਣਾ ਪੰਜ ਹਜ਼ਾਰ ਵਾਲਾ ਹੈਗਾ ਇਹਦੇ 'ਚ ਕੀ ਕੁਛ ਹੈ ਅਤੇ ਅਤੇ ਆਪਣਾ

ਠੀਕ ਆ ਠੀਕ ਆ ਠੀਕ ਆ ਠੀਕ ਆ ਚਲੋ ਅਸੀਂ ਅਸੀਂ ਬਣਾਉਂਦੇ ਹਾਂ ਪ੍ਰੋਗਰਾਮ ਤੁਹਾਡੇ ਨਾਲ ਨਾ ਫਾਈਨਲ ਕਰਦੇ ਹੈਗੇ ਹਾਂ ਅਤੇ ਮੈਂ ਹਾਂ ਮੈਂ ਤੁਹਾਡੇ ਨਾਲ ਕੰਟੈਕਟ ਕਰਦਾ ਓਕੇ ਜੀ ਹੈਂ